ਸਾਡੇ ਘਰ ਤੋਂ ਡਲਹੌਜ਼ੀ ਸ਼ਹਿਰ ਜੋ ਕਿ ਇੱਕ ਪਹਾੜ 'ਤੇ ਬਣਿਆ ਹੋਇਆ ਹੈ ਵਸਿਆ ਹੋਇਆ ਹੈ ਉਹ ਸਾਡੇ ਘਰ ਦੇ ਨੇੜੇ ਪੈਂਦਾ ਹੈ ਕਿਉਂਕਿ ਸਾਡੇ ਕਸਬੇ ਤੋਂ ਕਹਿ ਸਕਦੇ ਆ ਨੇੜੇ ਪੈਂਦਾ ਹੈ ਕਿਉਂਕਿ ਉਹ ਸਾ ਚਾਰ ਪੰਜ ਘੰਟਿਆਂ ਤੋਂ ਹੀ ਦੇ ਵਿੱਚ ਆਪਾਂ ਉੱਥੇ ਪਹੁੰਚ ਜਾਦੇ ਹਾਂ ਅਤੇ ਬਹੁਤ ਜੋ ਨਾਲ ਹੀ ਉੱਥੋਂ ਦਾ ਜਿਹੜਾ ਹੈ ਵਾਤਾਵਰਣ ਹੈਗਾ ਵਾ ਡਲਹੌਜ਼ੀ ਦਾ ਗਰਮੀਆਂ ਸਰਦੀਆਂ ਹਰ ਮੌਸਮ ਦੇ ਵਿੱਚ ਉੱਥੇ ਮੌਸਮ ਇੱਕ ਸਾਰ ਹੀ ਰਹਿੰਦਾ ਹੈ ਬਹੁਤ ਜ਼ਿਆਦਾ ਠੰਡ ਕਿਸੇ ਵੇਲੇ ਹੀ ਪੈਂਦੀ ਹੈ ਉੱਦਾਂ ਰੋਜ਼ ਮਰਾ ਦੇ ਵਿੱਚ ਗਰਮੀਆਂ ਸਰਦੀਆਂ ਟੈਂਪਰੇਚਰ ਗਰਮੀ ਜ਼ਿਆਦਾ ਗਰਮੀ ਦੇ ਵਿੱਚ ਵੀ ਉੱਥੇ ਬਹੁਤ ਜ਼ਿਆਦਾ ਗਰਮੀ ਨਹੀਂ ਪੈਂਦੀ ਅਤੇ ਠੀਕ ਰਹਿੰਦਾ ਮੌ ਮੌਸਮ ਸੁਹਾਵਨਾ ਹੁੰਦਾ ਹੈ ਅਤੇ ਉਹ ਸਾਡੇ ਕਸਬੇ ਦੇ ਕੋਲ ਕਰਕੇ ਜ਼ਿਆਦਾਤਰ ਲੋਕ ਉੱਥੇ ਡਲਹੌਜ਼ੀ ਜਾਣਾ ਪਸੰਦ ਕਰਦੇ ਹਨ ਆਪਣਾ ਛੁੱਟੀਆਂ ਦੇ ਵਿੱਚ ਜਾਂ ਵਿਹਲਾ ਟਾਈਮ ਕਰ ਕਰਨ ਲਈ ਉੱਥੇ ਵਾ ਸੈਲਾਨੀ ਦੂਰੋਂ ਦੂਰੋਂ ਵੀ ਆਉਂਦੇ ਹਨ ਕਿਉਂਕਿ ਉੱਥੇ ਹਰ ਟੈਂਪਰੇਚਰ ਸਾਰਾ ਸਾਲ ਇੱਕੋ ਜਿਹਾ ਹੋਣ ਕਰਕੇ ਦੂਰੋ ਦੂਰੋਂ ਬਾਹਰ ਸੈਲਾਨੀ ਆਉਂਦੇ ਹਨ ਅਤੇ ਜਦੋਂ ਬਰਫ਼ ਪੈਂਦੀ ਹਨ ਫਿਰ ਤਾਂ ਸੈਲਾਨੀਆਂ ਉੱਥੇ ਦੇਖਣ ਵਾਲਿਆਂ ਦੀ ਅਤੇ ਹੋਰ ਹੀ ਵੱਧ ਜਾਂਦੀ ਹੈ ਅਤੇ ਇਸ ਲਈ ਕਿਉਂ ਕਿ ਕਿਉਂਕਿ ਇੱਕ ਤਾਂ ਉੱਥੇ ਬੱਚਿਆਂ ਦੇ ਉੱਥੇ ਉਹ ਉੱਥੇ ਬੱਚਿਆਂ ਦੇ ਲਈ ਮਨੋਰੰਜਨ ਲਈ ਵੀ ਕਈ ਤਰ੍ਹਾ ਦੇ ਉੱਥੇ ਗੇਮਾਂ ਹਨ ਜਿਹਦੇ ਨਾਲ ਜਾ ਕੇ ਮਾ ਮਾਪੇ ਹੀ ਨਹੀਂ ਬੱਚੇ ਵੀ ਬਹੁਤ ਖੁਸ਼ ਹੁੰਦੇ ਹਨ